ਭਾਰਤ ਦੇ ਫੈਸ਼ਨ ਵਿੱਚ ਹੁਣ ਬਹੁਤ ਬਦਲਾਅ ਆ ਚੁੱਕਿਆ ਹੈ ਸਾਨੂੰ ਲੱਗਦਾ ਹੈ ਕਿ ਹੁਣ ਹੱਥ ਦੇ ਬਣੇ ਕੱਪੜੇ ਅਤੇ ਬਜ਼ਾਰੀ ਰੈਡੀਮੇਟ ਕੱਪੜਿਆਂ ਵਿੱਚ ਕੁਝ ਬਹੁਤਾ ਫ਼ਰਕ ਨਹੀਂ ਹੈ ਭਾਵੇਂ ਰੈਡੀਮੇਟ ਕੱਪੜਿਆਂ ਦੀ ਬਹੁਤ ਜ਼ਿਆਦਾ ਮਾਰਕੀਟ ਭਰੀ ਪਈ ਹੈ ਫਿਰ ਉਹ ਬਹੁਤ ਸਸਤੇ ਵੀ ਹੁੰਦੇ ਹਨ ਉਹ ਬਹੁਤ ਸੁੰਦਰ ਡਿਜ਼ਾਇਨਰ ਸੂਟ ਕੋਟ ਫਰਾਕ ਗਾਊਨ ਸ਼ਰਟਾਂ ਸੂਟ ਪੈਂਟ ਵਗੈਰਾ ਕਾਫੀ ਤਰ੍ਹਾਂ ਦੀ ਵਰਾਇਟੀ ਮਿਲ ਜਾਂਦੀ ਹੈ ਜੋ ਕਢਾਈਆਂ ਕੱਢੀਆਂ ਹੋਈਆਂ ਵੀ ਬਹੁਤ ਪਿਆਰੀਆਂ ਲੱਗਦੀਆਂ ਹਨ ਲੈਸਾਂ ਲੱਗੀਆਂ ਹੁੰਦੀਆਂ ਹਨ ਰੰਗਾਂ ਦਾ ਕੋਂਬੀਨੇਸ਼ਨ ਵੀ ਬਹੁਤ ਪਿਆਰਾ ਬਣਿਆ ਹੁੰਦਾ ਹੈ ਕਿਉਂਕਿ ਇਸ ਸਭ ਕੰਮ ਦੇ ਪਿੱਛੇ ਇੰਜੀਨੀਅਰ ਦਾ ਬਹੁਤ ਮਿਹਨਤ ਹੁੰਦੀ ਹੈ ਜੋ ਕਲਰ ਦੀ ਹਰ ਇੱਕ ਕੋਂਟ ਕੰਬੀਨੇਸ਼ਨ ਕਰਕੇ ਸੂਟ ਦੇ ਵਿੱਚ ਨਿਖਾਰ ਲਿਆਉਂਦੇ ਹਨ ਇੱਕ ਨਜ਼ਰ ਵਿੱਚ ਹੀ ਸਾਨੂੰ ਇਹ ਕੱਪੜੇ ਪਸੰਦ ਆ ਜਾਂਦੇ ਹਨ ਫਿਰ ਸਾਈਜ਼ ਦੀ ਵੀ ਕਮਾਲ ਦੀ ਫਿਟਿੰਗ ਆਉਂਦੀ ਹੈ ਅਸੀਂ ਜਿਸ ਹਿਸਾਬ ਨਾਲ ਆਪਣੇ ਸਾਈਜ਼ ਦਾ ਕੱਪੜਾ ਲੈਣਾ ਚਾਹੁੰਦੇ ਹਾਂ ਖ਼ਰੀਦ ਸਕਦੇ ਹਾਂ ਫਿਰ ਜਿਹੜਾ ਕੱਪੜਾ ਲੈਣਾ ਆ ਉਸਨੂੰ ਟਰਾਈ ਵੀ ਕਰਕੇ ਦੇਖ ਕੇ ਅਸੀਂ ਖ਼ਰੀਦ ਦੇ ਹਾਂ ਪਰ ਕਦੇ ਕਦੇ ਸਾਈਜ਼ ਦੀ ਮੁਕਸ਼ ਮੁਸ਼ਕਿਲ ਵੀ ਆ ਜਾਂਦੀ ਹੈ ਕਈ ਵਾਰੀ ਕਈ ਸਾਈਜ਼ ਛੋਟਾ ਹੋਵੇ ਤਾਂ ਬਹੁਤ ਟਾਈਟ ਹੋ ਜਾਂਦਾ ਹੈ ਉਹਦੀ ਫਿਟਿੰਗ ਨਹੀਂ ਆਉਂਦੀ ਜੇ ਥੋੜ੍ਹਾ ਵੱਡਾ ਲੈ ਲਓ ਸਾਈਜ਼ ਤਾਂ ਉਹ ਖੁੱਲਾ ਜ਼ਿਆਦਾ ਲੱਗਦਾ ਉਹ ਵੀ ਅੱਛਾ ਨਹੀਂ ਲੱਗਦਾ ਫਿਰ ਪਰੇਸ਼ਾਨੀ ਹੋ ਜਾਂਦੀ ਆ ਫਿਰ ਪਹਿਲਾਂ ਦੇ ਮੁਕਾਬਲੇ ਸਾਨੂੰ ਜਿਵੇਂ ਪਿਛਲੇ ਲੋਕ ਸੀਗੇ ਜਿਹੜੇ ਉਹ ਘਰ ਵਿੱਚ ਖੁਦ ਹੀ ਬੁਣਾਈ ਕਢਾਈ ਕਰਕੇ ਕੱਪੜਿਆਂ ਨੂੰ ਸਿਲਦੇ ਸੀ ਆਪਣੇ ਸਾਈਜ਼ ਦੇ ਅਕੋਰਡਿੰਗ ਉ ਉਹ ਸਾਨੂੰ ਵੀ ਉਹ ਹੀ ਤਕਨੀਕ ਅਪਣਾਉਣੀ ਪੈਂਦੀ ਹੈ ਜਿਸ ਲਈ ਸਾਨੂੰ ਫਿਰ ਕੱਪੜਾ ਲੈ ਕੇ ਖੁਦ ਆਪਣੀ ਮਨਪਸੰਦ ਦਾ ਫਿਰ ਉਸ 'ਤੇ ਲੈਸਿੰਗ ਵਰਕ ਜਾਂ ਕਢਵਾਏ ਕਢਾਈ ਦਾ ਕੋਈ ਕੰਮ ਕਰਨਾ ਹੋਏ ਜੋ ਸਾਡੀ ਪਸੰਦ ਦੇ ਸਾਨੂੰ ਅਕੋਰਡਿੰਗ ਚਾਹੀਦਾ ਫਿਰ ਉਹ ਸਾਨੂੰ ਉਹਦੇ 'ਤੇ ਕਰਵਾ ਕੇ ਫਿਰ ਬੁਟੀਕ ਤੋਂ ਸਾਨੂੰ ਖੁਦ ਡਿਜ਼ਾਇਨ ਕਰਵਾ ਕੇ ਤਿਆਰ ਕਰਵਾਉਣਾ ਪੈਂਦਾ ਹੈ ਕਿਸੇ ਵੇਲੇ ਤਾਂ ਬੁਟੀਕ ਵਾਲੇ ਵੀ ਬਹੁਤ ਅੱਛਾ ਕੰਮ ਕਰਦੇ ਹਨ ਪਰ ਕਈ ਵਾਰ ਕੱਪੜਾ ਖ਼ਰਾਬ ਵੀ ਕਰ ਦਿੰਦੇ ਹਨ ਫਿਰ ਬਹੁਤ ਦੁੱਖ ਵੀ ਲੱਗਦਾ ਹੈ ਇੰਨਾ ਪੈਸਾ ਇੰਨੀ ਚੋਇਸ ਇੰਨਾ ਸਭ ਕੁਛ ਲਗਾਉਣ ਤੋਂ ਬਾਅਦ ਵੀ ਸਾਡਾ ਫਿਟਿੰਗ ਸਹੀ ਨਹੀਂ ਆਈ ਸੂਟ ਖ਼ਰਾਬ ਕਰ ਦਿੱਤਾ ਮਿਹਨਤ ਖ਼ਰਾਬ ਹੋ ਜਾਂਦੀ ਹੈ ਫਿਰ ਫਿਰ ਸਾਡੇ ਕੱਪੜੇ ਖ਼ਰਾਬ ਕਰ ਦਿੱਤੇ ਜਾਂਦੇ ਹਨ ਫਿਰ ਉਦੇੜ ਬੁਣਾਈ ਦੇ ਵਿੱਚ ਖਿੱਚ ਦੇ ਕਾਰਨ ਧੋਆ ਧੁਆਈ ਕਰਨ ਦੇ ਨਾਲ ਜਿਹੜਾ ਕੱਪੜਾ ਆ ਉਹ ਖ਼ਰਾਬ ਹੋ ਜਾਂਦਾ ਹੈ ਇਸ ਦੇ ਅਕੋਰਡਿੰਗ ਜੇ ਦੇਖਿਆ ਜਾਵੇ ਅਤੇ ਜਿਹੜੀ ਅੱਜ ਦੀ ਰੈਡੀਮੇਟ ਕੁਆਲਿਟੀ ਹੈ ਉਹ ਬਹੁਤ ਬੈਸਟ ਹੈ ਜਿਹਦੀ ਫਿਟਿੰਗ ਵੀ ਬਹੁਤ ਬੈਸਟ ਹੈ ਕਲਰ ਕੋਂਬੀਨੇਸ਼ਨ ਵੀ ਅੱਛੇ ਨੇ ਜੋ ਵੀ ਅਸੀਂ ਜਿਸ ਦੇ ਅਕੋਰਡਿੰਗ ਲੋਕੇਸ਼ਨ ਦੇ ਜਾਂ ਫਿਰ ਕਿਸੇ ਫੈਸਟੀਵਲ ਦੇ ਅਕੋਰਡਿੰਗ ਜੋ ਕੱਪੜੇ ਚਾਹੁੰਦੇ ਹਾਂ ਉਹ ਸਾਨੂੰ ਰੈਡੀਮੇਟ ਮਿਲ ਜਾਂਦੇ ਨੇ ਕੁਝ ਅਸੀਂ ਲਾਗੇ ਉਹ ਮੌਲ ਹੈ ਅੱਛੇ ਬ੍ਰਾਂਡ ਦੇ ਕੱਪੜੇ ਲੈਣੇ ਹੋਣ ਉਹ ਮਿਲ ਜਾਂਦੇ ਨੇ ਸੈਵਨਟੀ ਏਟੀ ਪਰਸੈਂਟ ਹੋ ਆਫ 'ਤੇ ਵੀ ਮਿਲ ਜਾਂਦੇ ਨੇ ਉਹਨਾਂ ਦੀ ਕਲਰ ਸਟੋਰੇਜ ਹਰ ਇੱਕ ਚੀਜ਼ ਕੁਆਲਿਟੀ ਵਾਈਜ਼ ਅੱਛੇ ਹੁੰਦੇ ਨੇ ਡਰੈਸਿਸ ਵੀ ਮਿਲ ਜਾਂਦੀਆਂ ਨੇ ਤਾਂ ਇਸ ਲਈ ਸਾਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ ਕਿ ਕੱਪੜਾ ਲੈ ਕੇ ਫਿਰ ਤੋਂ ਦਰਾਣਾ ਪੁਰਾਣੇ ਲੋਕ ਜੋ ਪੱਛਮੀ ਟਾਈਮ ਦੇ ਸੀਗੇ ਉਹਨਾਂ ਨੂੰ ਪਹਿਲਾਂ ਕੱਪੜਾ ਲੈ ਕੇ ਉਸ 'ਤੇ ਉਹ ਕਢਾਈ ਕਰਨੀ ਬੁਣਾਈ ਕਰਨੀ ਉਹ ਬਹੁਤ ਤਿਆਰੀ 'ਚ ਟਾਈਮ ਲੱਗਦਾ ਸੀ ਅੱਜ ਕੱਲ੍ਹ ਰੈਡੀਮੇਡ ਸੂਟਾਂ ਦੀ ਇੰਨੀ ਕੋਈ ਟੈਨਸ਼ਨ ਨਹੀਂ ਹੁੰਦੀ ਜਾ ਕੇ ਆਪਣਾ ਸਾਈਜ ਸੈਟ ਕਰੋ ਅਤੇ ਕੱਪੜੇ ਖਰੀਦ ਸਕਦੇ ਹੋ ਬਾਕੀ ਕੱਪੜਿਆਂ ਦੇ ਦੌਰ ਦੇ ਵਿੱਚ ਸਾਨੂੰ ਅੱਜ ਕੱਲ੍ਹ ਵੈਸੇ ਪਾਉਣ ਵਿੱਚ ਪਹਿਲਾਂ ਤਾਂ ਆਪਾਂ ਸਲਵਾਰ ਸੂਟ ਹੀ ਪਸੰਦ ਕਰਦੇ ਸੀ ਬਟ ਚਲੋ ਹੁਣ ਫੈਸ਼ਨ ਦੇ ਅਕੋਰਡਿੰਗ ਜੀਨਸ ਵੀਅਰ ਕਰਨੀਆਂ ਵਧੀਆ ਲੱਗਦੀਆਂ ਨੇ ਇਸੀਲੀ ਬੰਦਾ ਵੇਅਰ ਕਰ ਲੈਂਦਾ ਹੈ ਟੋਪਸ ਪਾ ਲਏ ਜੀਨਸ ਪਾ ਲਏ ਸਕਰਟਸ ਪਾ ਲਈਆਂ ਐਨੀ ਵੰਨ ਔਰ ਕਿੰਨੀਆਂ ਚੀਜ਼ਾਂ ਨੇ ਪਾਉਣ ਨੂੰ ਜੋ ਵੇਅਰ ਕਰ ਸਕਦੇ ਹਾਂ